ਮੈਨੂੰ ਲੱਗਦਾ ਏ ਕਿ ਅਗਰ ਆਪਾਂ ਕਿਸੇ ਵੀ ਔਰਤ ਤੋਂ ਉਹਦੇ ਘਰ ਦੀ ਮਹੱਤਵਪੂਰਨ ਸਪੇਸ ਪੁੱਛੀਏ ਤਾਂ ਉਹਦੇ ਘਰ ਦੀ ਰਸੋਈ ਹੋਵੇਗੀ ਕਿਉਂਕਿ ਹਰ ਇੱਕ ਔਰਤ ਆਪਣੀ ਰਸੋਈ ਨੂੰ ਸਜਾਉਣ ਵਿੱਚ ਰੀਝਾਂ ਲਗਾ ਦਿੰਦੀ ਹੈ ਇਸੇ ਤਰ੍ਹਾਂ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਆਪਣੇ ਘਰ ਦੀ ਰਸੋਈ ਨੂੰ ਸਜਾਉਣ ਦੀ ਹਰ ਇੱਕ ਸੰਭਵ ਕੋਸ਼ਿਸ਼ ਕਰਦੀ ਰਹਿੰਦੀ ਹਾਂ ਜੇਕਰ ਮੈਂ ਆਪਣੇ ਘਰ ਦੀ ਰਸੋਈ ਦੀ ਮਹੱਤਤਾ ਦੱਸਾਂ ਤਾਂ ਮੇਰੇ ਘਰ ਦੀ ਰਸੋਈ ਦੇ ਵਿੱਚ ਤੁਹਾਨੂੰ ਵੱਖ ਵੱਖ ਤਰ੍ਹਾਂ ਦੇ ਬਰਤਨ ਦੇਖਣ ਨੂੰ ਮਿਲਣਗੇ ਜੇਕਰ ਮੈਂ ਗੱਲ ਕਰਾਂ ਕਾਂਸੀ ਦੇ ਬਰਤਨਾਂ ਦੀ ਤਾਂ ਕਾਂਸੀ ਦੇ ਬਰਤਨ ਖਾਣਾ ਬਣਾਉਣ ਲਈ ਬਹੁਤ ਜ਼ਿਆਦਾ ਚੰਗੇ ਸਮਝੇ ਜਾਂਦੇ ਨੇ ਪੁਰਾਣੇ ਜ਼ਮਾਨੇ ਵਿੱਚ ਇਹਨਾਂ ਨੂੰ ਚੰਗਾ ਸਮਝਿਆ ਜਾਂਦਾ ਸੀ ਇਸੇ ਤਰ੍ਹਾਂ ਹੀ ਹੋਰ ਆਪਾਂ ਮਿੱਟੀ ਦੇ ਭਾਂਡੇ ਦੀ ਗੱਲ ਕਰੀਏ ਤਾਂ ਮਿੱਟੀ ਦੇ ਬਰਤਨਾਂ ਵਿੱਚ ਅਗਰ ਆਪਾਂ ਪਾਣੀ ਪਾ ਕੇ ਰੱਖਦੇ ਹਾਂ ਤਾਂ ਉਹ ਪਾਣੀ ਪੀਣ ਲਈ ਸਿਹਤ ਲਈ ਬਹੁਤ ਜ਼ਿਆਦਾ ਲਾਭਦਾਇਕ ਹੈ ਹੁਣ ਅੱਜ ਕੱਲ੍ਹ ਸਟੇਨਲੈਸ ਸਟੀਲ ਐਲਮੂਨੀਅਮ ਦੇ ਬਰਤਨ ਚੱਲ ਗਏ ਅਗਰ ਆਪਾਂ ਗੱਲ ਕਰੀਏ ਪਿੱਤਲ ਦੇ ਬਰਤਨਾਂ ਦੀ ਹਾਲਾਂਕਿ ਪਿੱਤਲ ਦੇ ਬਰਤਨਾਂ ਵਿੱਚ ਭੋਜਨ ਪਰੋਸਣਾ ਠੀਕ ਆ ਪਰ ਖਾਣਾ ਬਣਾਉਣਾ ਨਹੀਂ ਕਿਉਂਕਿ ਜਦੋਂ ਪਿੱਤਲ ਗਰਮ ਹੁੰਦਾ ਹੈ ਤਾਂ ਉਹਦੇ ਵਿੱਚ ਨਮਕ ਅਤੇ ਹੋਰ ਧਾਤਾਂ ਖਾਦ ਪਦਾਰਥ ਨਾਲ ਪ੍ਰਕਿਰਿਆ ਕਰਦਾ ਹੈ ਇਸ ਲਈ ਆਪਾਂ ਨੂੰ ਇਹਨਾਂ ਵਿੱਚ ਖਾਣਾ ਪਕਾਉਣ ਤੋਂ ਬਚਣਾ ਚਾਹੀਦਾ ਹੈ ਸੋ ਹਰ ਇੱਕ ਧਾਤ ਦੀ ਅਲੱਗ ਅਲੱਗ ਮਹੱਤਤਾ ਏ ਸੋ ਮੈਂ ਆਪਣੇ ਕਿਚਨ ਦੇ ਵਿੱਚ ਵੱਖ ਵੱਖ ਧਾਤਾਂ ਦੇ ਬਰਤਨ ਰੱਖੇ ਹੋਏ ਨੇ ਅਤੇ ਹਰ ਇੱਕ ਦੀ ਆਪਣੀ ਇੰਪੋਰਟੈਂਸ ਏ